ਸਾਡੇ ਖੇਤਰ ਵਿੱਚ ਬਹੁਤ ਸਾਰੇ ਕਾਰੋਬਾਰ ਸ਼ੁਰੂ ਕੀਤੇ ਜਾ ਸਕਦੇ ਨੇ ਜਿਸ ਤਰ੍ਹਾਂ ਕਿ ਹੁਣ ਸਾਡੇ ਖੇਤਰ ਵਿੱਚ ਇੱਕ ਛੋਟੀ ਜਿਹੀ ਡੇਅਰੀ ਵੀ ਖੋਲ੍ਹੀ ਜਾ ਸਕਦੀ ਸਾਡੇ ਪਿੰਡ ਵਿੱਚ ਕਿਉਂਕਿ ਛੋਟੀ ਜਿਹੀ ਡੇਅਰੀ ਨਹੀਂ ਹੈਗੀ ਦੁਕਾਨ ਜਿਸ ਤਰ੍ਹਾਂ ਕਿ ਹੁਣ ਦੁੱਧ ਦਹੀਂ ਪਨੀਰ ਮਿਲ ਪਾਏ ਇੱਥੋਂ ਸਾਨੂੰ ਦੂਰ ਜਾਣਾ ਪੈਂਦਾ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਇਹ ਵੀ ਕਾਰੋਬਾਰ ਚੱਲ ਸਕਦਾ ਹੈ ਇਹ ਪਿੰਡ ਵਿੱਚ ਇੱਕ ਛੋਟਾ ਜਿਹਾ ਰੈਸਟੋਰੈਂਟ ਖੋਲ੍ਹਿਆ ਜਾਵੇ ਉਹ ਵੀ ਖੋਲ੍ਹਿਆ ਜਾ ਸਕਦਾ ਉਹ ਵੀ ਚੱਲ ਸਕਦਾ ਜਿਸ ਤਰ੍ਹਾਂ ਇੱਕ ਹੁਣ ਸਾਡੇ ਪਿੰਡ ਵਿੱਚ ਕੋਈ ਪਾਰਲਰ ਨਹੀਂ ਹੈਗੀ ਪਾਰਲਰ ਦਾ ਕੰਮ ਵੀ ਇੱਥੇ ਚੱਲ ਸਕਦਾ ਹੈ ਉਹ ਵੀ ਜੇ ਕੋਈ ਖੋਲ੍ਹੇ ਤਾਂ ਬਹੁਤ ਕੰਮ ਚੱਲੇਗਾ ਕਾਰੋਬਾਰ ਚੱਲ ਸਕਦਾ ਸਾਡੇ ਪਿੰਡ ਵਿੱਚ ਜਿਸ ਤਰ੍ਹਾਂ ਹੁਣ ਕਰਿਆਨੇ ਦੀ ਦੁਕਾਨ ਆ ਉਹ ਵੀ ਲੋਕਾਂ ਨੂੰ ਦੂਰ ਜਾ ਹੱਟੀ ਸ਼ਹਿਰ ਜਾ ਕੇ ਸੌਦਾ ਕਰਿਆਨੇ ਦਾ ਸਮਾਨ ਖਰੀਦਣਾ ਪੈਂਦਾ ਜੇ ਸਾਡੇ ਪਿੰਡ ਵਿੱਚ ਦੁਕਾਨ ਹੋਵੇਗੀ ਅਤੇ ਲੋਕ ਆਪਣੇ ਪਿੰਡ ਤੋਂ ਹੀ ਸੌਦਾ ਲੈ ਪਾਉਣਗੇ ਖਰੀਦ ਪਾਉਣਗੇ ਦੂਰ ਨਹੀਂ ਜਾਣਾ ਪਵੇਗਾ ਜਿਸ ਤਰ੍ਹਾਂ ਹੁਣ ਇੱਥੇ ਮਨਿਆਰੀ ਦੀ ਦੁਕਾਨ ਵੀ ਚੱਲ ਸਕਦੀ ਆ ਮਨਿਆਰੀ ਦੀ ਦੁਕਾਨ ਵੀ ਪਾਈ ਜਾ ਸਕਦੀ ਹੈ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਪਿੰਡ ਵਿੱਚ ਦੁਕਾਨਾਂ ਨਹੀਂ ਹੈਗੀਆਂ ਕਾਰੋਬਾਰ ਨਹੀਂ ਹੈਗੇ ਇਹੋ ਜਿਹੇ ਕਾਰੋਬਾਰ ਚੱਲ ਸਕਦੇ ਨੇ ਇੱਥੇ ਪਾਰਲਰ ਦਾ ਹੋਇਆ ਕਰਿਆਨੇ ਦਾ ਹੋਇਆ ਮਨਿਆਰੀ ਹੋਇਆ ਇਹ ਆਦਿ ਸਾਰੇ ਬਹੁਤ ਸਾਰੀਆਂ ਕਾਰੋਬਾਰ ਇੱਦਾਂ ਦੇ ਚੱਲ ਸਕਦੇ ਨੇ ਦੂਸਰੀ ਗੱਲ ਹੈ ਕਿ ਜਿਸ ਤਰ੍ਹਾਂ ਹੁਣ ਮੈਨੂੰ ਮੈਂ ਕਰਨਾ ਚਾਹੁੰਦੀ ਕੰਮ ਜਿਸ ਤਰ੍ਹਾਂ ਮੈਂ ਕੋਈ ਕਾਰੋਬਾਰ ਖੋਲ੍ਹਣਾ ਵਾ ਕਿ ਮੈਂ ਖੋਲ੍ਹਣਾ ਚਾਹੁੰਦੀ ਹਾਂ ਕਿ ਮੈਂ ਜਿਸ ਤਰ੍ਹਾਂ ਹੁਣ ਆਪਣੀ ਮੈਨੂੰ ਕੁਕਿੰਗ ਦਾ ਬਹੁਤ ਸੌਂਕ ਹੈ ਮੈਂ ਕੁਕਿੰਗ ਖਾਣਾ ਬਹੁਤ ਵਧੀਆ ਸੋਹਣੇ ਤਰੀਕੇ ਨਾਲ਼ ਬਣਾਉਂਦੀ ਹਾਂ ਸਵਾਦਿਸ਼ਟ ਵੀ ਹੁੰਦਾ ਵਾ ਖਾਣ ਵਾਲੇ ਨੂੰ ਵੀ ਮੋਹ ਲੈਂਦਾ ਇਸ ਕਰਕੇ ਮੈਂ ਆਪਣਾ ਛੋਟਾ ਜਿਹਾ ਰੈਸਟੋਰੈਂਟ ਖੋਲ੍ਹਣਾ ਚਾਹਾਂਗੀ ਕਿ ਆਪਣਾ ਰੈਸਟੋਰੈਂਟ ਇੱਥੇ ਇੱਕ ਛੋਟਾ ਜਿਹਾ ਖੋਲ੍ਹਾਂ ਸੋਹਣਾ ਸਵਾਦਿਸ਼ਟ ਖਾਣਾ ਬਣਾਵਾਂ ਅਤੇ ਲੋਕਾਂ ਨੂੰ ਖਵਾ ਪਾਵਾਂ ਅਤੇ ਨਾਲ਼ੇ ਮੈਨੂੰ ਫਾਇਦਾ ਹੋਵੇਗਾ ਇਹ ਕਾਰੋਬਾਰ ਦਾ ਅਤੇ ਜਿਸ ਤਰ੍ਹਾਂ ਹੁਣ ਕੋਈ ਇੱਦਾਂ ਦੀਆਂ ਵੀ ਔਰਤਾਂ ਨੇ ਜਿਹੜੀਆਂ ਕੰਮ ਕਰਨ ਜਾਂਦੀਆਂ ਨੇ ਆਪਣੇ ਕੋਈ ਦੂਰ ਕਿਤੇ ਦਿਹਾੜੀ ਵਗੈਰਾ ਨਾ ਉਹ ਸੋ ਦੂਰੋਂ ਆਉਂਦੀਆਂ ਨੇ ਹਨੇਰੇ ਸਵੇਰੇ ਆਉਂਦੀਆਂ ਨੇ ਉਹਨਾਂ ਨੂੰ ਵੀ ਸੌਖ ਹੋ ਜੂਗੀ ਕਿ ਆਣ ਕਿ ਮੇਰੇ ਰੈਸਟੋਰੈਂਟ ਦਾ ਖਾਣਾ ਖਾ ਪਾਉਣ ਨਾਲ਼ੇ ਮੈਨੂੰ ਫਾਇਦਾ ਹੋਵੇਗਾ ਨਾਲ਼ੇ ਉਹਨਾਂ ਨੂੰ ਹੋਵੇਗਾ ਇਸ ਕਰਕੇ ਮੇਰਾ ਇਹ ਕਾਰੋਬਾਰ ਵੀ ਚੱਲ ਸਕਦਾ ਅਤੇ ਮੈਂ ਕਰਨਾ ਚਾਹਵਾਂਗੀ